ਵਿਸਾਖੀ ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਵਿੱਚ ਇੱਕ ਮਹੱਤਵਪੂਰਨ ਤਿਉਹਾਰ ਹੈ ਇਹ ਸਲਾਨਾ ਫਸਲ ਦੀ ਕਟਾਈ ਨਵੀਂ ਫਸਲ ਦੇ ਆਰੰਭ ਅਤੇ ਖੇਤੀਬਾੜੀ ਨਾਲ ਜੁੜੀ ਖੁਸ਼ੀਆਂ ਦਾ ਪ੍ਰਤੀਕ ਹੈ ਖੇਤੀਬਾੜੀ ਵਿਸਾਖੀ ਦੇ ਮੌਕੇ 'ਤੇ ਖੇਤਾਂ ਵਿੱਚ ਕਟਾਈ ਦਾ ਸਮਾਂ ਹੁੰਦਾ ਹੈ ਜਿਸ ਨੂੰ ਪੰਜਾਬ ਵਿੱਚ ਬਹੁਤ ਜਸ਼ਨ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਇਹ ਦਿਨ ਸੋਲ੍ਹਾਂ ਸੌ ਨੜ੍ਹਿਨਵੇਂ ਵਿੱਚ ਖਾਲਸਾ ਪੰਥ ਦੀ ਸਥਾਪਨਾ ਦਾ ਵੀ ਸ਼ਿੰਕਲ ਹੈ ਇਸ ਦੌਰਾਨ ਗੁਰੂ ਜੀ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਸਿੱਖਾਂ ਨੂੰ ਇਕੱਠਾ ਕਰਕੇ ਖਾਲਸਾ ਦੀ ਗਵਾਹੀ ਦਿੱਤੀ ਸੀ ਪੂਜਾ ਪਾਠ ਸਿੱਖ ਗੁਰਦੁਆਰੇ ਵਿੱਚ ਖਾਸ ਬੰਦਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਅਤੇ ਭਗਤਾਂ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ ਜੱਤੀਆਂ ਅਤੇ ਮੋਸਰੀਆਂ ਲੋਕ ਆਪਣੇ ਖੇਤਾਂ ਵਿੱਚ ਖੁਸ਼ੀਆਂ ਮਨਾਉਂਦੇ ਹਨ ਵਾਜੇ ਗੀਤ ਅਤੇ ਨੱਚਣ ਨਾਲ ਖੇਤਾਂ ਵਿੱਚ ਜੋਸ਼ ਦੇ ਨਾਲ ਜਸ਼ਨ ਮਨਾਉਂਦੇ ਹਨ ਪੰਛੀ ਸੱਭਿਆਚਾਰ ਲੋਕ ਆਪਣੇ ਰਿਵਾਇਤਾਂ ਜਿਵੇਂ ਕਿ ਭੰਗੜਾ ਅਤੇ ਗਿੱਧੇ ਦੇ ਨਾਲ ਇਸ ਦਿਨ ਨੂੰ ਖ਼ਾਸ ਬਣਾਉਂਦੇ ਹਨ